ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਗੌਰਮੈਂਟ ਸਕੂਲ ਆ ਜਾਂਦਾ ਜੀ ਗਰਲ ਨੂੰ ਲਾਉਣਾ ਜਾਂ ਬੋਆਏ ਨੂੰ ਅੱਛਾ ਮੁੰਡੇ ਵਾਸਤੇ ਹਾਂਜੀ ਇੱਥੇ ਸਰਕਾਰੀ ਸਕੂਲ ਮਿਲ ਜਾਵੇਗਾ ਤੁਹਾਨੂੰ ਸੈਂਟ ਸਹਾਰਾ ਸਕੂਲ ਮਿਲ ਜਾਵੇਗਾ ਜੀ ਸ਼ਿਵਾਲਿਕ ਪਬਲਿਕ ਸਕੂਲ ਮਿਲ ਜਾਵੇਗਾ ਅਤੇ ਹੋਰ ਕੋਂਨਵੈਂਟ ਸਕੂਲ ਮਿਲ ਜਾਵੇਗਾ ਜੀ ਤੁਸੀਂ ਮਤਲਬ ਕਿ ਇੱਕ ਆਦੇਸ਼ ਮਾਡਲ ਸਕੂਲ ਮਿਲ ਜਾਵੇਗਾ ਜੀ ਅਤੇ ਇੱਥੋਂ ਦੇ ਮਤਲਬ ਕਿ ਵਧੀਆ ਸਕੂਲਾਂ ਦੇ ਵਿੱਚ ਸਾਰਿਆਂ ਦੇ ਵਿੱਚ ਵਧੀਆ ਫਸਿਲਟੀ ਸਹੀ ਸਾਰੇ ਮਤਲਬ ਕਿ ਬੱਚੇ ਪੜ੍ਹਾਈ ਵਗੈਰਾ ਵਧੀਆ ਹੁੰਦੀ ਹੈ ਟੂਰ ਵਗੈਰਾ 'ਤੇ ਜਾਂਦੇ ਟ੍ਰਿਪ ਵਗੈਰਾ ਲੈ ਕੇ ਜਾਂਦੇ ਹੈ ਟੀਚਰ ਸਾਰੇ ਟੀਚਰ ਪ੍ਰੋਵਾਈਡ ਹੈਗੇ ਹੈ ਜੀ ਉੱਥੇ ਅਤੇ ਮਤਲਬ ਕਿ ਇਹਨਾਂ ਦਾ ਰਿਜਲਟ ਵਗੈਰਾ ਟੋਪ ਲੈਵਲ 'ਤੇ ਆਉਂਦਾ ਜੀ ਅਤੇ ਮਤਲਬ ਕਿ ਬੱਚਿਆਂ ਨੂੰ ਟੂਰਿਸਟ ਵਗੈਰਾ ਵੀ ਲੈ ਕੇ ਜਾਂਦੇ ਹੈਗੇ ਆ ਅਤੇ ਹੋਰ ਵੀ ਮਤਲਬ ਕਿ ਬੱਸ ਵਗੈਰਾ ਦੀ ਵੀ ਸਹੂਲਤ ਹੈਗੀ ਹੈ ਜੀ ਫੀਸ ਉਹ ਕਲਾਸ ਦੇ ਅਕੋਰਡਿੰਗ ਹੁੰਦੀ ਹੈ ਜੀ ਬਾਕੀ ਤੁਸੀਂ ਮਤਲਬ ਕਿ ਲੈਸ ਹੋ ਜੂਗੀ ਇੱਕ ਵਾਰੀ ਤੁਸੀਂ ਮਤਲਬ ਕਿ ਵਿਜਿਟ ਕਰ ਲਿਆਏ ਸਕੂਲ ਜੋ ਤੁਹਾਨੂੰ ਬੈਟਰ ਲੱਗੇ ਹਾਂਜੀ ਆਦੇਸ਼ ਹਾਂਜੀ ਹੋਸਟਲ ਦੀ ਫਸਿਲਟੀ ਵੀ ਹੈਗੀ ਹੈ ਜੀ ਮਤਲਬ ਕਿ ਆਦੇਸ਼ ਵੀ ਆ ਜਾਂਦਾ ਆਦਰਸ਼ ਮਾਡਲ ਸਕੂਲ ਆ ਜਾਂਦਾ ਜੀ ਪ੍ਰਾਈਵੇਟ ਦੇ ਵਿੱਚ ਕੋਂਨਵੈਂਟ ਸਕੂਲ ਇਹ ਵੀ ਪ੍ਰਾਈਵੇਟ ਦੇ ਵਿੱਚ ਆ ਜਾਂਦਾ ਜੀ ਸੀ ਬੀ ਐਸ ਈ ਬੋਰਡ ਅਤੇ ਹਾਂਜੀ ਹੋਰ ਕੁਛ ਜੀ ਪੁੱਛਣਾ ਹੋਵੇ ਹਾਂਜੀ ਹਾਂਜੀ ਪ੍ਰੋਵਾਈਡ ਆ ਜੀ ਹੋਸਟਲ ਦੇ ਵਿੱਚ ਵਧੀਆ ਫਸਿਲਟੀਸ ਹੈਗੀਆਂ ਜੀ ਰਹਿਣ ਖਾਣ ਦਾ ਵਧੀਆ ਪ੍ਰਬੰਧ ਹੈਗਾ ਜੀ ਹਾਜ ਹਾਂਜੀ ਹਾਂਜੀ ਉਹ ਮਤਲਬ ਪਾਰਟੀਸੀਪੇਸ਼ਨ ਹੁੰਦੀ ਆ ਜੀ ਬੱਚੇ ਦੀ ਉਹ ਮਤਲਬ ਕਿ ਸਿਖਾਉਂਦੇ ਵੀ ਹੈਗੇ ਜੀ ਖੇਡਾਂ ਉਹਨਾਂ ਨੂੰ ਅਤੇ ਮਤਲਬ ਕਿ ਡਿਸਟਰਿਕਟ ਲੈਵਲ 'ਤੇ ਬਲੋਕ ਲੈਵਲ 'ਤੇ ਮਤਲਬ ਕਿ ਉਹਨਾਂ ਦੇ ਮੁਕਾਬਲੇ ਕਰਵਾਏ ਜਾਂਦੇ ਅਤੇ ਮਤਲਬ ਪ੍ਰਾਈਜ ਵਗੈਰਾ ਦਿੱਤੇ ਜਾਂਦੇ ਸਨਮਾਨਿਤ ਕੀਤਾ ਜਾਂਦਾ ਵਧੀਆ ਹਾਂਜੀ ਉਹ ਤੁਹਾਨੂੰ ਮੈਂ ਮਤਲਬ ਕਿ ਡਿਟੇਲ ਭੇਜ ਦੂਗੀ ਤੁਸੀਂ ਉੱਥੇ ਸਭ ਕੁਛ ਲਿਖਿਆ ਹੋਊਗਾ ਜੀ ਐਡਰੈਸ ਵਗੈਰਾ ਠੀਕ ਆ ਜੀ ਓਕੇ ਜੀ